ਦੇਖਿਆ ਜਾਵੇ ਤਾਂ ਮੈਂ ਕਾਫੀ ਚੀਜ਼ਾਂ ਨੂੰ ਦੇਖ ਕੇ ਖੁਸ਼ ਹੁੰਦੀ ਹਾਂ ਕਿਉਂਕਿ ਮੇਰਾ ਸੁਭਾਅ ਬਹੁਤ ਅਲੱਗ ਹੈ ਮੈਂ ਹਰੇਕ ਚੀਜ਼ ਨਾਲ ਮਿਲ ਜੁਲ ਕੇ ਰਹਿੰਦੀ ਹਾਂ ਪਰ ਜੋ ਚੀਜ਼ ਦੇਖ ਕੇ ਮੈਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਉਹ ਹੈ ਮੋਬਾਇਲ ਫੋਨ ਅਤੇ ਕੰਪਿਊਟਰ ਇਸ ਜਗ੍ਹਾ 'ਤੇ ਉਸਦੇ ਬਹੁਤ ਜ਼ਿਆਦਾ ਲਾਭ ਹਨ ਦੂਜੀ ਜਗ੍ਹਾ 'ਤੇ ਇਹ ਨੁਕਸਾਨ ਵੀ ਦਿੰਦੇ ਹਨ ਪਰ ਮੈਂ ਇਹ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਵਰ ਵਰਤੋਂ ਕਰਦੀ ਹਾਂ ਕੰਪਿਊਟਰ ਦੀ ਗੱਲ ਕਰੀਏ ਤਾਂ ਇਹ ਯੰਤਰ ਮਨੁੱਖੀ ਸਮਾਜ 'ਤੇ ਹਰ ਖੇਤਰ ਉੱਤੇ ਆਪਣੀ ਅਮਿੱਟ ਛਾਪ ਲੈ ਚੁੱਕਾ ਹੈ ਇਸ ਨੇ ਮਨੁੱਖ ਦੀ ਦਿਮਾਗੀ ਸ਼ਕਤੀ ਵਿੱਚ ਕਈ ਗੁਣਾ ਵਾਧਾ ਕੀਤਾ ਹੈ ਇਹ ਅਣਗਿਣਤ ਕੰਮ ਬਿਨਾਂ ਥਕਾਵਟ ਕਰਦਾ ਹੈ ਅੱਜ ਹਰੇਕ ਵੱਡੇ ਧੰਦੇ ਤਕਨੀਕੀ ਸੰਸਥਾਵਾਂ ਅਗਾਮੀ ਉਤਪਾਦਨ ਅਨੁਮਾਨ ਪ੍ਰੀਖਿਆ ਫਲਾਂ ਦੀਆਂ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈ ਡਾਕਟਰੀ ਅਤੇ ਅਖ਼ਬਾਰੀ ਦੁਨੀਆਂ ਵਿੱਚ ਅੱਜ ਕੰਪਿਊਟਰ ਪ੍ਰਣਾਲੀ ਦੀ ਸਭ ਤੋਂ ਵੱਧ ਲਾਭਦਾਇਕ ਅਤੇ ਗ਼ਲਤੀ ਰਹਿਤ ਜਾਣਕਾਰੀ ਹੈ ਡਿਜ਼ਾਇਨ ਅਤੇ ਖੇਤਰ ਵਿੱਚ ਤਾਂ ਕੰਪਿਊਟਰ ਨੇ ਕ੍ਰਾਂਤੀ ਹੀ ਲਿਆ ਦਿੱਤੀ ਹੈ ਸੰਚਾਰ ਅਤੇ ਕੰਪਿਊਟਰ ਨੈਟਵਰਕ ਕੰਪਿਊਟਰ ਨੈਟਵਰਕ ਨੇ ਦੁਨੀਆਂ ਭਰ ਵਿੱਚ ਸੰਚਾਰ ਦੇ ਖੇਤਰ ਵਿੱਚ ਦੀ ਜਗ੍ਹਾ ਲੈ ਲਈ ਹੈ ਕੰਪਿਊਟਰ ਨੈਟਵਰਕ ਜੋ ਹੈ ਉਹ ਤਿੰਨ ਰੂਪ ਵਿੱਚ ਪ੍ਰਾਪਤ ਹੁੰਦਾ ਹੈ ਜਿਸ ਨੂੰ ਲੈਨ ਮੈਨ ਅਤੇ ਵੈਨ ਕਿਹਾ ਜਾਂਦਾ ਹੈ ਮੈਨ ਤੋਂ ਭਾਵ ਹੈ ਮੈਟਰੋਪਲਿਸ਼ਨ ਨੈੱਟਵਰਕ ਜਿਸ ਵਿੱਚ ਇੱਕ ਅਦਾਰੇ ਜਾਂ ਕੰਪਨੀ ਦੇ ਵੱਖ ਵੱਖ ਸ਼ਹਿਰਾਂ ਅਤੇ ਸਥਾਨਾਂ ਉੱਤੇ ਸਥਿਤ ਦਫ਼ਤਰਾਂ ਦੇ ਕੰਪਿਊਟਰ ਆਪਸ ਵਿੱਚ ਜੁੜੇ ਰਹਿੰਦੇ ਹਨ ਇਸ ਰਾਹੀਂ ਅਸੀਂ ਈਮੇਲ ਉੱਤੇ ਇੱਕ ਦੂਜੇ ਨਾਲ ਸੁਨੇਹਾ ਵੀ ਭੇਜ ਸਕਦੇ ਹਾਂ ਇਸ ਤੋਂ ਜਿਸ ਪ੍ਰਕਾਰ ਦੀ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ ਅਸੀਂ ਪ੍ਰਾਪਤ ਕਰ ਸਕਦੇ ਹਾਂ ਉਸੀ ਜਗ੍ਹਾ ਅਗਰ ਅਸੀਂ ਦੇਖੀਏ ਤਾਂ ਮੋਬਾਈਲ ਫੋਨ ਦੇ ਕੀ ਲਾਭ ਹਨ ਮੋਬਾਇਲ ਫੋਨ ਜਿਸ ਨੂੰ ਸੈਲੀ ਸੈੱਲ ਫੋਨ ਵੀ ਕਹਿੰਦੇ ਹਨ ਵਰਤਮਾਨ ਸੰਸਾਰ ਵਿੱਚ ਸੰਚਾਰ ਦਾ ਸਭ ਤੋਂ ਹਰਮਨ ਪਿਆਰਾ ਸਾਧਨ ਬਣ ਗਿਆ ਹੈ ਅੱਜ ਤੁਸੀਂ ਭਾਵੇਂ ਕਿਤੇ ਵੀ ਹੋਵੋ ਤੁਹਾਨੂੰ ਇੱਧਰ ਉੱਧਰ ਕੋਈ ਨਾ ਕੋਈ ਸੈੱਲ ਫੋਨ ਉੱਤੇ ਗੱਲਾਂ ਕਰਦਾ ਵੀ ਦਿਸ ਪਵੇਗਾ ਜਾਂ ਘੱਟੋ ਘੱਟ ਕਿਸੇ ਦੀ ਜੇਬ ਜਾਂ ਪਰਸ ਵਿੱਚ ਸੈੱਲ ਫੋਨ ਦੀ ਘੰਟੀ ਵੱਜਦੀ ਜ਼ਰੂਰੀ ਸੁਨ ਜ਼ਰੂਰ ਸੁਣੀ ਸੁਣ ਪਵੇਗੀ ਅੱਜ ਤੋਂ ਚੌਵੀ ਪੱਚੀ ਸਾਲ ਪਹਿਲਾਂ ਜਦੋਂ ਅਮਰੀਕਾ ਵਿੱਚ ਅਤੇ ਬਾਰ੍ਹਾਂ ਤੇਰ੍ਹਾਂ ਸਾਲ ਪਹਿਲਾਂ ਭਾਰਤ ਵਿੱਚ ਇਸ ਦਾ ਪ੍ਰਚਲਨ ਆਰੰਭ ਹੋਇਆ ਤਾਂ ਇਸ ਨੂੰ ਇੱਕ ਨਯਾਬ ਚੀਜ਼ ਸਮਝਿਆ ਜਾਂਦਾ ਸੀ ਪਰ ਅੱਜ ਇਹ ਅਜਿਹੀ ਚੀਜ਼ ਬਣ ਗਈ ਹੈ ਇਸਨੂੰ ਹਰ ਅਮੀਰ ਗਰੀਬ ਪ੍ਰਾਪਤ ਕਰ ਸਕਦਾ ਹੈ